ਮੇਰੇ ਲਿਖਣ ਦੀਆਂ ਕੁਝ ਆਦਤਾਂ ਨੇ ਜਿਨ੍ਹਾਂ ਨੂੰ ਮੈਂ ਰੂਟੀਨ ਵੀ ਬਣਾਇਆ ਹੋਇਆ ਹੈ ਅਤੇ ਉਹਨਾਂ ਦੀ ਮੈਂ ਪਾਲਣਾ ਕਰਨ ਦੀ ਵੀ ਕੋਸ਼ਿਸ਼ ਕਰਦੀ ਹਾਂ ਜਿਵੇਂ ਉਸ ਦੇ ਨਾਲ ਇੱਕ ਤਾਂ ਲਿਖਤ ਦੇ ਵਿੱਚ ਅਨੁਸ਼ਾਸਨ ਬਣਿਆ ਰਹਿੰਦਾ ਕਿ ਜੋ ਵੀ ਇੱਕ ਵਿਚਾਰ ਦੇ ਬਾਰੇ ਤੁਸੀਂ ਕੋਈ ਕੁਛ ਲਿਖ ਰਹੇ ਹੋ ਕੋਈ ਲੇਖ ਲਿਖਿਆ ਜਾ ਰਿਹਾ ਹੈ ਤਾਂ ਮੈਨੂੰ ਲੱਗਦਾ ਕਿ ਮੈਂ ਜਦੋਂ ਇੱਕ ਲੇਖ ਨੂੰ ਆਰੰਭ ਕਰ ਲੈਂਦੀ ਹਾਂ ਤਾਂ ਉਹਦੇ ਬਾਰੇ ਜਦੋਂ ਅਸੀਂ ਰੂਟੀਨ ਦੇ ਵਿੱਚ ਲੱਗੇ ਰਹਿੰਦੇ ਹਾਂ ਸੋਚਦੇ ਰਹਿੰਦੇ ਹਾਂ ਅਤੇ ਲਿਖਦੇ ਰਹਿੰਦੇ ਹਾਂ ਤਾਂ ਉਸ ਵਿੱਚ ਇੱਕ ਅਨੁਸ਼ਾਸਨ ਬਣਿਆ ਰਹਿੰਦਾ ਇੱਕ ਗੱਲ ਦੇ ਉੱਤੇ ਸਾਰਾ ਜਿਹੜਾ ਲੇਖ ਹੈ ਉਹ ਕੇਂਦਰਿਤ ਰਹਿੰਦਾ ਜਦੋਂ ਉਸ ਅਪ ਆਪਾਂ ਰੂਟੀਨ ਨਹੀਂ ਬਣਾਉਂਦੇ ਤਾਂ ਗੱਲ ਹੈ ਜਿਹੜੀ ਕੇਂਦਰ ਤੋਂ ਹਟ ਜਾਂਦੀ ਹੈ ਦੂਰ ਹੋ ਜਾਂਦੀ ਹੈ ਇਸ ਕਰਕੇ ਕੇਂਦਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਅਤੇ ਕੇਂਦਰ ਤਾਂ ਹੀ ਬਣ ਸਕਦਾ ਜਦੋਂ ਅਸੀਂ ਕਿਸੇ ਵੀ ਲਿਖਤ ਦੇ ਉੱਤੇ ਹਮੇਸ਼ਾ ਸੋਚਦੇ ਰਹਿੰਦੇ ਹਾਂ ਉਸ ਦੇ ਵਿੱਚ ਇੱਕ ਇੱਕ ਇਕਸਾਰਤਾ ਬਣੀ ਰਹਿੰਦੀ ਹੈ ਇੱਕ ਅਨੁਸ਼ਾਸਨ ਵੀ ਕਾਇਮ ਰਹਿੰਦਾ ਆਰੰਭ ਤੋਂ ਲੈ ਕੇ ਅੰਤ ਤੱਕ ਜਿਹੜੀ ਇੱਕ ਇਕਾਗਰਤਾ ਹੈ ਉਹ ਤੁਹਾਡੀ ਲਿਖਤ ਦੇ ਵਿੱਚੋਂ ਵੀ ਸਾਹਮਣੇ ਆਉਂਦੀ ਹੈ ਇਕਾਗਰਤਾ ਤਾਂ ਹੀ ਹੁੰਦੀ ਹੈ ਜਦੋਂ ਇੱਕੇ ਵਿਸ਼ੇ ਬਾਰੇ ਬੰਦਾ ਸੋਚ ਰਿਹਾ ਹੁੰਦਾ ਅਤੇ ਉਸੇ ਬਾਰੇ ਹੀ ਲਿਖ ਰਿਹਾ ਹੁੰਦਾ ਅਤੇ ਮੈਂ ਇਹ ਹਮੇਸ਼ਾ ਹੀ ਕਰਦੀ ਹਾਂ ਕਿ ਜਦੋਂ ਇੱਕ ਵਿਸ਼ੇ ਨੂੰ ਛੋਹ ਲਿਆ ਜਾਂਦਾ ਛੋਹ ਲੈਂਦੀ ਹਾਂ ਤਾਂ ਉਸ ਵਿਸ਼ੇ ਬਾਰੇ ਹੀ ਉਸ ਤਰ੍ਹਾਂ ਦੀਆਂ ਗੱਲਾਂ ਹੀ ਉਸ ਲਿਖਤ ਦੇ ਵਿੱਚ ਕੀਤੀਆਂ ਜਾਂਦੀਆਂ ਹਨ